ਹਾਂਜੀ ਅਸੀਂ ਆਪਣੀ ਭੈਣ ਅਤੇ ਧੀ ਅਤੇ ਦੋਸਤਾਂ ਦੀ ਸਿੱਖਿਆ ਪੂਰੀ ਕਰਨਾ ਚਾਹੁੰਦੇ ਹਾਂ ਲੇਕਿਨ ਉਹਨਾਂ ਨੂੰ ਪੂਰੀ ਕਰਨ ਲੱਗਿਆਂ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਾਡੇ ਮਾਂ ਪਿਓ ਸਾਨੂੰ ਜ਼ਿਆਦਾ ਘਰ ਚੋਂ ਬਾਹਰ ਨਹੀਂ ਕੱਢਦੇ ਅਤੇ ਨਾ ਹੀ ਕੋਈ ਫੈਨੈਂਸ਼ੀਅਸ਼ ਪ੍ਰੋਬਲਮਸ ਕਰਕੇ ਉਹ ਸਾਡੇ ਜ਼ਿਆਦਾ ਖਰਚਾ ਕਰ ਸਕਦੇ ਹਨ